ਭਾਰਤ ਹਮੇਸ਼ਾਂ ਆਪਣੀ ਕਲਾ ਅਤੇ ਆਰਕੀਟੈਕਚਰ ਲਈ ਜਾਣਿਆ ਜਾਂਦਾ ਰਿਹਾ ਹੈ ਕਲਾ ਦੇ ਲਿਹਾਜ਼ ਨਾਲ ਭਾਰਤ ਦਾ ਇਤਿਹਾਸ ਬਹੁਤ ਵਿਸ਼ਾਲ ਹੈ ਲਗਭਗ ਹਰ ਰਾਜ ਦੀ ਆਪਣੀ ਕਲਾ ਹੁੰਦੀ ਹੈ ਜਿਸ ਦੀ ਵਿਸ਼ੇਸ਼ਤਾ ਹੁੰਦੀ ਹੈ ਅਤੇ ਭਾਰਤ ਦੇ ਆਦਿਵਾਸੀ ਭਾਈਚਾਰਿਆਂ ਦੀ ਕਲਾ ਸਭ ਤੋਂ ਵੱਧ ਜੀਵਤ ਹੈ ਇਹ ਕਬਾਇਲੀ ਕਲਾ ਪ੍ਰਤੀਕਾਤਮਕ ਪਹਿਲੂਆਂ ਵਿੱਚ ਅਮੀਰ ਸਨ ਕਿਉਂਕਿ ਇਹਨਾਂ ਵਿੱਚ ਬਹੁਤ ਖਾਸ ਰੀਤੀ ਰਿਵਾਜ਼ ਅਤੇ ਵਿਸ਼ੇਸ਼ਤਾਵਾਂ ਸਨ ਆਓ ਇਹਨਾਂ ਕਬਾਇਲੀ ਕਲਾਵਾਂ ਬਾਰੇ ਹੋਰ ਜਾਣੀਏ ਇੱਥੇ ਭਾਰਤ ਦੀਆਂ ਦਸ ਕਬਾਇਲੀ ਕਲਾਵਾਂ ਹਨ ਬਾਹਰਲੀ ਲੋਕ ਚਿੱਤਰ ਤੰਜੋਰ ਪੇਂਟਿੰਗਸ ਮਧੂਬਨੀ ਕਲਾ ਸਾਹੋਰਾ ਪੇਂਟਿੰਗਸ ਭੀਲ ਕਲਾ ਗੋਂਡ ਪਟਾ ਚਿੱਤਰ ਚਿੱਤਰਕਾਰੀ ਕਲਾਮ ਜੇਥੂ ਕਲਾ ਖੋਵਰ ਕਲਾ ਕਾਵੜ ਜਾਂ ਕਵਾੜ ਕਲਾ ਪਹਿਲੀ ਆਉਂਦੀ ਆ ਬਾਹਰਲੀ ਲੋਕ ਚਿੱਤਰ ਬਾਹਰਲੀ ਲੋਕ ਚਿੱਤਰ ਮਹਾਰਾਸ਼ਟਰ ਰਾਜ ਨਾਲ ਸੰਬੰਧਿਤ ਇਹ ਕਬਾਇਲੀ ਕਲਾ ਇਸ ਦੇ ਮੁੱਢਲੇ ਚਿੱਤਰਾਂ ਲਈ ਮਸ਼ਹੂਰ ਹੈ ਇਹ ਲੋਕ ਚਿੱਤਰਕਾਰੀ ਦੀਆਂ ਉੱਤਮ ਉਦਾਹਰਨਾਂ ਵਿੱਚੋਂ ਇੱਕ ਹੈ ਇਸ ਵਿੱਚ ਮੂਲ ਜਿਓਮੈਟ੍ਰੀਕਲ ਅਕਾਰਾਂ ਦੀ ਵਰਤੋਂ ਕੀਤੀ ਜਾਂਦੀ ਹੈ ਜਿਵੇਂ ਵਰਗ ਚੱਕਰ ਅਤੇ ਕੌਣ ਇਹ ਚਿੱਤਰ ਗੂੜੇ ਰੰਗ ਨਾਲ ਰੰਗ ਦੇ ਪਿੱਠ ਭੂਮੀ 'ਤੇ ਚਿੱਟੇ ਰੰਗ ਬੁਰਸ਼ ਵੱਜੋਂ ਵਰਤੇ ਜਾਂਦੇ ਬਾਂਸ ਵਿੱਚ ਉਖਰੀਆਂ ਗਈਆਂ ਹਨ ਪੇਂਟਿੰਗ ਸ਼ਿੰਗਾਰ ਪੇਂਟਿੰਗ ਸ਼ਿਕਾਰ ਤਿਉਹਾਰਾਂ ਮੱਛੀਆਂ ਫੜਨ ਖੇਤੀ ਨਾਚ ਅਤੇ ਰੋਜ਼ਾਨਾ ਜੀਵਨ ਦੇ ਹੋਰ ਦਿਸ਼ਾ ਨੂੰ ਦਰਸਾਉਂਦੀਆਂ ਹਨ ਸਾਹੋਰਾ ਪੇਂਟਿੰਗਸ ਸਾਹੋਰਾ ਕੰਧ ਚਿੱਤਰਾਂ ਚਿੱਤਰਾਂ ਦੀ ਇੱਕ ਸ਼ੈਲੀ ਹੈ ਜੋ ਉੜੀਸਾ ਦੇ ਸਾਹੋਰਾ ਕਬੀਲੇ ਰਾਜ ਨਾਲ ਸੰਬੰਧਿਤ ਹੈ ਇਹ ਚਿੱਤਰ ਉੜੀਸਾ ਰਾਜ ਤੋਂ ਵੀ ਪੈਦਾ ਹੋਏ ਹਨ ਪਰ ਮਹਾਰਾਸ਼ਟਰ ਮੱਧ ਪ੍ਰਦੇਸ਼ ਅਤੇ ਝਾਰਖੰਡ ਰਾਜਾਂ ਵਿੱਚ ਇਹ ਰਾਜਾਂ ਵਿੱਚ ਵੀ ਇਹ ਮਿਲਦੇ ਹਨ ਉਹਨਾਂ ਨੂੰ ਆਈਕਨ ਵੀ ਕਿਹਾ ਜਾਂਦਾ ਹੈ ਪੇਂਟਿੰਗ ਦੀ ਪਿੱਠ ਭੂਮੀ ਲਾਲ ਜਾਂ ਪੀਲੇ ਚਿੱਤਰ ਜਾਂ ਪੀਲੇ ਉਚਰ ਤੋਂ ਤਿਆਰ ਕੀਤੀ ਗਈ ਹੈ ਜੋ ਬੁਰਸ਼ ਅਤੇ ਬਾਂਸ ਦੀ ਵਰਤੋਂ ਕਰਕੇ ਪੇਂਟ ਕੀਤੀ ਜਾਂਦੀ ਹੈ ਬਹੁਤ ਹੀ ਸਧਾਰਨ ਅੰਕੜੇ ਵਰਤੇ ਜਾਂਦ ਵਰਤੇ ਗਏ ਹਨ ਜੋ ਇੱਕ ਪਿੰਡ ਦੇ ਕਿਸਾਨ ਦੇ ਸਧਾਰਨ ਪਰ ਅਰਥ ਪੂਰਨ ਰੋਜ਼ਾਨਾ ਜੀਵਨ ਨੂੰ ਦਰਸਾਉਂਦੇ ਹਨ ਇਹ ਚਿੱਤਰ ਬਾਹਰਲੀ ਚਿੱਤਰਾਂ ਦੇ ਸਮਾਨ ਹਨ ਦੋਵਾਂ ਵਿਚਲਾ ਅੰਤਰ ਸਿਰਫ ਰੇਖਾ ਗਣਿਤਕ ਅੰਕੜਿਆਂ ਦੀ ਵਰਤੋਂ ਹੈ ਇਹ ਪੇਂਟਿੰਗਸ ਵਿਆਹ ਬੱਚੇ ਦੇ ਜਨਮ ਜਾਂ ਕਿਸੇ ਹੋਰ ਵਿਸ਼ੇਸ਼ ਮੌਕੇ 'ਤੇ ਖਿੱਚੀਆਂ ਜਾਂਦੀਆਂ ਹਨ ਭੀਲ ਕਲਾ ਭੀਲ ਭਾਰਤ ਦਾ ਦੂਜਾ ਸਭ ਤੋਂ ਵੱਡਾ ਆਦਿਵਾਸੀ ਭਾਈਚਾਰਾ ਹੈ ਭੀਲ ਕਲਾ ਨੂੰ ਵੀ ਇਹਨਾਂ ਦੀ ਹੀ ਦੇਣ ਹੈ ਮੱਧ ਪ੍ਰਦੇਸ਼ ਰਾਜਸਥਾਨ ਗੁਜਰਾਤ ਮਹਾਰਾਸ਼ਟਰ ਰਾਜਾਂ ਤੋਂ ਪੈਦਾ ਹੋਈ ਇਹ ਕਲਾ ਖੁਦ ਭੀਲਾਂ ਦੇ ਜੀਵਨ ਨੂੰ ਉਜਾਗਰ ਕਰਦੀ ਹੈ ਇਸ ਕਬੀਲੇ ਨੇ ਜੀਵਨ ਨੂੰ ਜੀਵਤ ਰੰਗਾਂ ਵਿੱਚ ਦਰਸਾਉਣ ਲਈ ਬਿੰਦੀਆਂ ਦੀ ਵਰਤੋਂ ਕੀਤੀ ਉਹ ਆਪਣੀ ਕਲਾ ਅਤੇ ਚਿੱਤਰਕਾਰੀ ਨੂੰ ਆਪਣੇ ਦੇਵੀ ਦੇਵਤਿਆਂ ਅਤੇ ਕੁਦਰਤ ਨਾਲ ਜੋੜਨ ਦੀ ਕੋਸ਼ਿਸ਼ ਕਰਦੇ ਹਨ ਇਸ ਵਿੱਚ ਦੀਵਾਰਾਂ ਜਾਂ ਕਾਗਜ਼ਾਂ 'ਤੇ ਕੁਦਰਤੀ ਅਤੇ ਜੜੀ ਬੂਟੀਆਂ ਦੇ ਰੰਗਾਂ ਤੋਂ ਸੂਰਜ ਚੰਦਰਮਾ ਕੁਦਰਤ ਦੇਵਤਿਆਂ ਆਦਿ ਦੀ ਨਿਕਾਸੀ ਸ਼ਾਮਿਲ ਹੈ ਪੇਂਟਿੰਗ ਦੇ ਪਿੱਛੇ ਦੀ ਕਹਾਣੀ ਨੂੰ ਆਸਾਨੀ ਨਾਲ ਸਮਝਿਆ ਜਾ ਸਕਦਾ ਹੈ ਕਵਾੜ ਜਾ ਕਾਵੜ ਕਲਾ ਰਾਜਸਥਾਨ ਦੀ ਕਾਵੜ ਜਾਂ ਕਵਾੜ ਕਾਵੜ ਜਾਂ ਕਵਾਰ ਕਲਾ ਲਗਭਗ ਪੰਜ ਸੌ ਸਾਲ ਪੁਰਾਣੀ ਕਲਾ ਹੈ ਜੋ ਚਿੱਤੌੜਗੜ੍ਹ ਤੇ ਜੰਗੀ ਬ੍ਰਾਹਮਣਾਂ ਦੁਆਰਾ ਅਭਿਆਸ ਕੀਤੀ ਜਾਂਦੀ ਹੈ ਇਹ ਇੱਕ ਤਿੰਨ ਅਯਾਮੀ ਬੋਕਸ ਹੈ ਜਿਸ ਵਿੱਚ ਕਈ ਪੈਂਸਿਲਾਂ ਹਨ ਜਿਸ ਨੂੰ ਖੋਲ੍ਹਿਆ ਜਾ ਸਕਦਾ ਹੈ ਇਹ ਇੱਕ ਪੋਰਟੇਬਲ ਮੰਦਰ ਹੈ ਜਿਸ ਵਿੱਚ ਵੱਖ ਵੱਖ ਦੇਵੀ ਦੇਵਤਿਆਂ ਨੂੰ ਚਿੱਤਰਿਆ ਜਾਂਦਾ ਹੈ ਇਹ ਪੈਨਲ ਹਲਕੇ ਲੱਕੜ ਦੇ ਬਣੇ ਹੁੰਦੇ ਹਨ ਅਤੇ ਰਮਾਇਣ ਪੁਰਾਨਾ ਭਗਵਤ ਗੀਤਾ ਅਤੇ ਹੋਰ ਬਹੁਤ ਸਾਰੇ ਮਹਾਂਕਾਵਿਆਂ ਦੀਆਂ ਕਹਾਣੀਆਂ ਨੂੰ ਦਰਸਾਉਂਦੇ ਹਨ ਇਹ ਬੜੇ ਮਾਨ ਦੀ ਗੱਲ ਹੈ ਕਿ ਭਾਰਤ ਦੀਆਂ ਕਬਾਇਲੀ ਕਲਾਵਾਂ ਦਾ ਅੱਜ ਵੀ ਅਭਿਆਸ ਕੀਤਾ ਜਾਂਦਾ ਹੈ ਅਤੇ ਕਈ ਥਾਵਾਂ 'ਤੇ ਅਤੇ ਲੋਕਾਂ ਨੇ ਇਸ ਨੂੰ ਇੰਨੇ ਸਾਲਾਂ ਬਾਅਦ ਵੀ ਜਿਉਂਦਾ ਰੱਖਿਆ ਹੋਇਆ ਹੈ